ਜਦੋਂ ਬੁਣਾਈ ਅਤੇ ਸਿਲਾਈ ਦੀ ਗੱਲ ਆਉਂਦੀ ਹੈ ਤਾਂ ਸਵੈਟਰ ਸਕਾਰ ਅਤੇ ਕੰਬਲ ਵਰਗੇ ਕੱਪੜੇ ਆਮ ਤੌਰ 'ਤੇ ਬਣਾਏ ਜਾਂਦੇ ਹਨ ਕਿਉਂਕਿ ਉਹ ਬਹੁਪੱਖੀਤਾ ਅਤੇ ਵਿਹਾਰਕਤਾ ਦੀ ਪੇਸ਼ਕਸ਼ ਕਰਦੇ ਹਨ ਇਹ ਆਈਟਮਾਂ ਨਾ ਸਿਰਫ ਕਾਰਜਸ਼ੀਲ ਹਨ ਸਗੋਂ ਵੱਖ ਵੱਖ ਪੈਟਰਨਾਂ ਅਤੇ ਤਕਲੀਫਾਂ ਰਾਹੀਂ ਸਿਰਜਾਨ ਸਿਰਜਣਾਤਮਕ ਪ੍ਰਗਟਾਵੇ ਦੀ ਆਗਿਆ ਵੀ ਦਿੰਦੀਆਂ ਹਨ ਸਵੈਟਰ ਅਤੇ ਕੰਬਲ ਉਦਾਹਰਣ ਲਈ ਵੱਖ ਵੱਖ ਸ਼ੈਲੀਆਂ ਅਤੇ ਮੌਸਮ ਦੀਆਂ ਸਥਿਤੀਆਂ ਲਈ ਅਨੁਕੂਲਿਤ ਕੀਤੇ ਜਾ ਸਕਦੇ ਹਨ ਉਹਨਾਂ ਨੂੰ ਨਿੱਜੀ ਵਰਤੋਂ ਅਤੇ ਤੋਹਫਿਆਂ ਦੋਵਾਂ ਲਈ ਪ੍ਰਸਿੱਧ ਵਿਕਲਪ ਬਣਾਉਂਦੇ ਹੋਏ ਵਿਅਕਤੀਗਤ ਤੌਰ 'ਤੇ ਮੈਂ ਕਲਾਸਕ ਟੁਕੜੇ ਬਣਾਉਣ ਦਾ ਆਨੰਦ ਲੈਂਦਾ ਜਿਵੇਂ ਕਿ ਅਨੁਕੂਲਿਤ ਜੈਕਟਾਂ ਅਤੇ ਗੁੰਝਲਦਾਰ ਪਹਿਰਾਵੇ ਜੋ ਇੱਕ ਚੁਣੌਤੀ ਅਤੇ ਪ੍ਰਾਪਤੀ ਦੀ ਭਾਵਨਾ ਦੋਵਾਂ ਦੀ ਪੇਸ਼ਕਸ਼ ਕਰਦੇ ਹਨ ਟੇਲਰ ਜੈਕਟਾਂ ਵਿਸਤ੍ਰਿਤ ਕੰਮ ਕਰਨ ਦੀ ਇਜਾਜ਼ਤ ਦਿੰਦੀਆਂ ਹਨ ਅਤੇ ਇੱਕ ਪਾਲਸ਼ਰ ਫਾਨੀਸ਼ ਪ੍ਰਦਾਨ ਕਰਦੀਆਂ ਹਨ ਜਦੋਂ ਕਿ ਕੱਪੜੇ ਵੱਖ ਵੱਖ ਮੌਕਿਆਂ ਲਈ ਅਨੁਕੂਲਿਤ ਕੀਤੇ ਜਾ ਸਕਦੇ ਹਨ ਤੇਜ਼ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਲਈ ਮੈਂ ਫੈਬਰਿਕ ਦੇ ਟੁਕੜਿਆਂ ਨੂੰ ਬਰੀਕ ਕੱਟਣ ਅਤੇ ਇਕਸਾਰਤਾ ਲਈ ਟੈਪਲੇਟਾਂ ਦੀ ਵਰਤੋਂ ਕਰਨ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਦੀ ਹਾਂ ਬੁਣਾਈ ਵਿੱਚ ਮੈਂ ਅਕਸਰ ਸਹਿਜ ਪ੍ਰੋਜੈਕਟਾਂ ਲਈ ਸਰਕੂਲਰ ਸੂਈਆਂ ਦੀ ਵਰਤੋਂ ਕਰਦੀ ਹਾਂ ਜੋ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ ਅਤੇ ਮੁਕੰਮਲ ਕੰਮ ਨੂੰ ਘਟਾ ਸਕਦਾ ਹੈ ਇਹ ਤਕਨੀਕਾਂ ਅੰਤਿਮ ਉਤਪਾਦ ਵਿੱਚ ਉੱਚ ਗੁਣਵੱਤਾ ਨੂੰ ਕਾਇਮ ਰੱਖਦੇ ਹੋਏ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਦੀਆਂ ਹਨ